ਪੰਜਾਬ ਦੇ ਕਿੱਤਿਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਪੰਜਾਬ ਦੇ ਵਿੱਚ ਕਿਸਾਨ ਖੇਤੀਬਾੜੀ ਕਰਦੇ ਸੀ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਂਦਾ ਸੀ ਲੁਹਾਰ ਲੋਹੇ ਦਾ ਕੰਮ ਕਰਦਾ ਸੀ ਅਤੇ ਸੁਨਿਆਰ ਸਿਉਨੇ ਦਾ ਕੰਮ ਕਰਦਾ ਸੀਗਾ ਇਹ ਸਾਰੇ ਕਿੱਤੇ ਪੰਜਾਬ ਦੇ ਵਿੱਚ ਰਿਵਾਇਤੀ ਹਨ ਇਨ੍ਹਾਂ ਦੇ ਵਿੱਚ ਜਿਹੜਾ ਸਭ ਤੋਂ ਜਿਆਦਾ ਮਹੱਤਵਪੂਰਨ ਕਿੱਤਾ ਹੈ ਉਹ ਖੇਤੀਬਾੜੀ ਦਾ ਖੇਤੀਬਾੜੀ ਦਾ ਕਿੱਤਾ ਸਭ ਤੋਂ ਪੁਰਾਣਾ ਹੈ ਪੰਜਾਬ ਦੇ ਲੋਕ ਖੇਤੀਬਾੜੀ ਕਰਕੇ ਹੀ ਅੱਜ ਖੁਸ਼ਹਾਲ ਜੀਵਨ ਆਪਣਾ ਬਤੀਤ ਕਰ ਰਹੇ ਹਨ ਜੇਕਰ ਆਪਾਂ ਖੇਤੀਬਾੜੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੋਂ ਜਿਹੜਾ ਕਿਸਾਨ ਸੀ ਉਹ ਪੁਰਾਣੇ ਢੰਗਾਂ ਦੇ ਨਾਲ ਖੇਤੀ ਕਰਦਾ ਸੀ ਪਹਿਲਾਂ ਬਲਦਾਂ ਨਾਲ ਖੇਤੀ ਕਰਦਾ ਸੀ ਫੇਰ ਹਲਟਾਂ ਦੇ ਨਾਲ ਪਾਣੀ ਲਾਉਂਦਾ ਸੀ ਜਿਹਦੇ ਨਾਲ ਬਹੁਤ ਸਮਾਂ ਲੱਗਦਾ ਸੀ ਤੇ ਕਿਸਾਨ ਗਰੀਬ ਹੁੰਦਾ ਸੀ ਉਹਦੇ ਕੋਲ ਐਨੇ ਸਾਧਨ ਨਈਂ ਸੀ ਹੁੰਦੇ ਕੀ ਉਹ ਚੰਗੀਆ ਚੰਗੀਆ ਖਾਦਾਂ ਦੀ ਵਰਤੋਂ ਕਰ ਸਕੇ ਅਤੇ ਆਪਣੀ ਫਸਲ ਦਾ ਧਿਆਨ ਰੱਖ ਸਕੇ ਫੇਰ ਹੌਲੀ ਹੌਲੀ ਇਸ ਕਿੱਤੇ ਦੇ ਵਿੱਚ ਬਹੁਤ ਵਿਕਾਸ ਹੋਇਆ ਨਵੀਆਂ ਨਵੀਆਂ ਖੋਜਾਂ ਹੋਈਆਂ ਫੇਰ ਉੱਨੀ ਸੌ ਛਿਆਟ ਸਤਾਟ ਦੇ ਵਿੱਚ ਹਰੀ ਕ੍ਰਾਂਤੀ ਆਈ ਹਰੀ ਕ੍ਰਾਂਤੀ ਆਉਣ ਦੇ ਨਾਲ ਇੱਥੇ ਖੇਤੀਬਾੜੀ ਨਾਲ ਸਬੰਧਿਤ ਨਵੀਆਂ ਨਵੀਆਂ ਖਾਦਾਂ ਨਵੇਂ ਨਵੇਂ ਬੀਜ ਅਤੇ ਸਿੰਚਾਈ ਦੇ ਵੱਖਰੇ ਵੱਖਰੇ ਢੰਗਾਂ ਦਾ ਵਿਕਾਸ ਹੋਇਆ ਜਿਹਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਲਾਭ ਲਿਆ ਅਤੇ ਸਾਡੀ ਖੇਤੀਬਾੜੀ ਪ੍ਰਫੁਲਿੱਤ ਹੋਈ ਅੱਜ ਸਾਡੀ ਖੇਤੀਬਾੜੀ ਦੀ ਜਿਹੜੀ ਚਰਚਾ ਉਹ ਉਹ ਫੋਰਨ ਕੰਟਰੀ ਦੇ ਵਿੱਚ ਵੀ ਹੁੰਦੀ ਹੈ ਸਾਰੇ ਲੋਕ ਪੰਜਾਬ ਦੇ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਦੀ ਮਹਾਨਤਾ ਨੂੰ ਜਾਣਦੇ ਹਨ ਸਾਰੇ ਲੋਕ ਫਸਲਾਂ ਨੂੰ ਪਸੰਦ ਕਰਦੇ ਹਨ ਅਤੇ ਪੰਜਾਬ ਨੂੰ ਅਨਾਜ ਦੀ ਟੋਕਰੀ ਕਿਹਾ ਜਾਂਦਾ ਹੈ ਬਾਕੀ ਗੱਲ ਕਰੀਏ ਆਪਾਂ ਦੂਜੇ ਕਿੱਤਿਆਂ ਦੀ ਜਿਵੇਂ ਤਰਖਾਣ ਦਸਤਕਾਰੀ ਕਿੱਤੇ ਹੋਗੇ ਤਰਖਾਣ ਪਹਿਲਾਂ ਘਰੇਲੂ ਵਸਤਾਂ ਬਣਾਉਂਦਾ ਸੀਗਾ ਪਿੰਡ ਦੇ ਵਿੱਚ ਆਮ ਘਰੇਲੂ ਯੂਜ ਹੋਣ ਵਾਲੀਆਂ ਚੀਜਾਂ ਘਰੇ ਬਣਾਉਂਦਾ ਸੀਗਾ ਅਤੇ ਹੌਲੀ ਹੌਲੀ ਇਸ ਕਿੱਤੇ ਨੇ ਵੀ ਬਹੁਤ ਜਿਆਦਾ ਤਰੱਕੀ ਕੀਤੀ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਵੀ ਜਿਹੜੇ ਘਰਾਂ ਦੇ ਵਿੱਚ ਚੀਜਾਂ ਲੱਗਦੀਆਂ ਨੇਗੀਆਂ ਉਹ ਬਹੁਤ ਜਿਆਦਾ ਅਡਵਾਂਸ ਹੋ ਗੀਆਂ ਨੇ ਚਾਹੇ ਉਹ ਕਪਬੋਡ ਹੋਗੇ ਚਾਹੇ ਉਹ ਹੋਮ ਡਿਜ਼ਾਇਨਿੰਗ ਹੋਗੀ ਤੇ ਹਰ ਇੱਕ ਤਰੀਕੇ ਦਾ ਜਿਹੜਾ ਤਰੀਕ ਦੇ ਵਿੱਚ ਬਦਲਾਅ ਆ ਰਿਹਾ ਹੈ ਲੋਕ ਨਵੇਂ ਤੋਂ ਨਵੇਂ ਲੱਕੜ ਦੇ ਡਿਜ਼ਾਈਨ ਦੇ ਨਾਲ ਹਿਸਾਬ ਨਾਲ ਘਰ ਬਣਾ ਰਹੇ ਹਨ ਤਾਂ ਇਹ ਸਾਰੇ ਜਿਹੜੇ ਕਿੱਤੇ ਨੇ ਉਹ ਪੰਜਾਬ ਨਾਲ ਸਬੰਧ ਰੱਖਦੇ ਹਨ ਤੇ ਅੱਜ ਇਹ ਕਿੱਤੇ ਬਹੁਤ ਉੱਚਾਈ ਤੇ ਪਹੁੰਚ ਚੁੱਕੇ ਹਨ ਧੰਨਵਾਦ